ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਦੱਸੋ ਜੀ ਹਾਂਜੀ ਬੀਬੀ ਨਾਨਕੀ ਗੁਰਦੁਆਰੇ ਤੇ ਬੋਲਦੇ ਜੀ ਦੱਸੋ ਜੀ ਕੀ ਪੁੱਛਣਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਸਰ ਅਤੇ ਕੋਈ ਨਹੀਂ ਸਰ ਤੁਸੀਂ ਆ ਜਿਓ ਸਾਡੇ ਅਸੀਂ ਤੁਹਾਨੂੰ ਮੈਨੇਜਰ ਸਾਹਿਬ ਨਾਲ ਮਿਲਾ ਦਾਂਗੇ ਮੈਨੇਜਰ ਸਾਹਿਬ ਦੀ ਤੁਸੀਂ ਕਰ ਲਿਓ ਅਤੇ ਤੁਸੀਂ ਕੀ ਓਡੀਓ ਕਿ ਇਕੱਲੀ ਕਿ ਵੀਡੀਓ ਕਰਨੀ ਆ ਤੁਸੀਂ ਇੰਟਰਵਿਊ ਅੱਛਾ ਓਡੀਓ ਕਰੋਗੇ ਠੀਕ ਹੈ ਕੋਈ ਨਾ ਸਰ ਤੁਸੀਂ ਨਾ ਟਾਈਮ ਲੈ ਲਿਓ ਮੈਨੇਜਰ ਸਾਹਿਬ ਜਾਂ ਤਾਂ ਦੁਪਹਿਰ ਨੂੰ ਫਰੀ ਹੁੰਦੇ ਆ ਜਾਂ ਫਿਰ ਸ਼ਾਮ ਨੂੰ ਬਾਅਦ ਫਰੀ ਹੁੰਦੇ ਆ ਉਹ ਮਿਲ ਤੁਸੀਂ ਹਜੇ ਕਿੱਥੇ ਹੋ ਜੀ ਤੁਸੀਂ ਨਾ ਕਪੂਰਥਲਾ ਕਪੂਰਥਲੇ ਪਹੁੰਚ ਕੇ ਉਥੋਂ ਬਾਏ ਬੱਸ ਵੀ ਜਾਂ ਬਾਏ ਕਾਰ ਵੀ ਬਿਲਕੁਲ ਸਿੱਧੀ ਰੋਡ ਆ ਕਪੂਰਥਲਾ ਸੁਲਤਾਨਪੁਰ ਜੀ ਹਾਂਜੀ ਇਹ ਕੋਈ ਪੈ ਜਾਣਾ ਜੀ ਤੁਹਾਨੂੰ ਪੱਚੀ ਤੋਂ ਤੀਹ ਦੇ ਵਿੱਚ ਵਿੱਚ ਪੈ ਜਾਣਾ ਹਾਂਜੀ ਠੀਕ ਹੈ ਸਰ ਕੋਈ ਨਹੀਂ ਤੁਸੀਂ ਆ ਜਿਓ ਆ ਕੇ ਮੈਨੂੰ ਫੋਨ ਕਰ ਲਿਓ ਅਤੇ ਫਿਰ ਆਪਾਂ ਮਿਲ ਲਵਾਂਗੇ ਠੀਕ ਹੈ ਜੀ ਓਕ